ਮੈਂ ਰੋਜ਼ ਸਵੇਰੇ ਸ਼ਾਮ ਦੌੜਦਾ ਹਾਂ ਮੈਂ ਆਪਣਾ ਜ਼ਿਆਦਾਤਰ ਸਮਾਂ ਦੌੜਨ ਵਿੱਚ ਬਤੀਤ ਕਰਦਾ ਹਾਂ ਅਤੇ ਰੋਜ਼ ਦੌੜਨ ਦੀ ਮੈਨੂੰ ਪ੍ਰੇਰਨਾ ਮੇਰੇ ਘਰ ਤੋਂ ਮਿਲਦੀ ਹੈ